ਸਾਡੇ ਪਿੰਡਾਂ ਵਿੱਚ ਇੰਨੀ ਸ਼ੁੱਧ ਹਵਾ ਚਲਦੀ ਹੈ ਕਿ ਕਿਸੇ ਦਾ ਗਲਾ ਖਰਾਬ ਨਹੀਂ ਹੁੰਦਾ ਜੇਕਰ ਕਿਸੇ ਦਾ ਗਲਾ ਖਰਾਬ ਹੁੰਦਾ ਵੀ ਹੈ ਤਾਂ ਅਸੀਂ ਸਾਰੇ ਘਰੇਲੂ ਉਪਚਾਰਾਂ ਦੀ ਵਰਤੋਂ ਕਰਦੇ ਹਾਂ ਘਰੇਲੂ ਉਪਚਾਰ ਉਹ ਹੁੰਦੇ ਹਨ ਜਿਹੜੇ ਅਸੀਂ ਘਰ ਵਿੱਚ ਹੀ ਤਿਆਰ ਕਰਦੇ ਹਾਂ ਘਰੇਲੂ ਉਪਚਾਰ ਬਹੁਤ ਤਰ੍ਹਾਂ ਦੇ ਹੁੰਦੇ ਹਨ ਗਲੇ ਨੂੰ ਸਾਫ ਕਰਨ ਵਾਸਤੇ ਜਿਵੇਂ ਕਿ ਗਰਮ ਪਾਣੀ ਵਿੱਚ ਨਮਕ ਪਾ ਕੇ ਉਸਦੇ ਗਰਾਰੇ ਕਰ ਸਕਦੇ ਹਾਂ ਦੂਸਰਾ ਚਾਹ ਵਿੱਚ ਅਦਰਕ ਨਮਕ ਪਾ ਕੇ ਤੁਸੀਂ ਉਸਦਾ ਸੇਵਨ ਕਰ ਸਕਦੇ ਹੋ ਤੀਸਰਾ ਉਪਕਾਰ ਇਹ ਹੈ ਮਲੇਠੀ ਦੰਦਾਂ ਦੇ ਨੀਚੇ ਰੱਖ ਕੇ ਤੁਸੀਂ ਉਸਨੂੰ ਚਬਾ ਸਕਦੇ ਹੋ ਇਸ ਨਾਲ ਕੀ ਹੋਵੇਗਾ ਜਿਹੜਾ ਤੁਹਾਡੇ ਗਲੇ ਵਿੱਚ ਕੋਈ ਧੂੜ ਮਿੱਟੀ ਬਲਗਮ ਆਦਿ ਫਸਿਆ ਹੋਵੇਗਾ ਜਾਂ ਮਤਲਬ ਫਸਿਆ ਹੋਵੇਗਾ ਜਾਂ ਰੁਕਿਆ ਹੋਵੇਗਾ ਉਹ ਸਾਰਾ ਬਾਹਰ ਆ ਜਾਵੇਗਾ ਜਾਂ ਪਿਸ਼ਾਬ ਦੁਆਰਾ ਬਲਗਮ ਨਿਕਲ ਵੀ ਸਕਦਾ ਹੈ ਇਸ ਤਰ੍ਹਾਂ ਅਸੀਂ ਘਰੇਲੂ ਉਪਚਾਰ ਕਰਕੇ ਆਪਣਾ ਗਲਾ ਸਾਫ ਕਰ ਸਕਦੇ ਹਾਂ ਬਾਹਰੋਂ ਕੋਈ ਵੀ ਦਵਾਈ ਦਾ ਅਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸੇਵਨ ਨਹੀਂ ਕਰਦੇ ਤੁਸੀਂ ਵੀ ਇਸ ਤਰ੍ਹਾਂ ਘਰ ਵਿੱਚ ਘਰੇਲੂ ਉਪਚਾਰਾਂ ਦੀ ਵਰਤੋਂ ਕਰਕੇ ਆਪਣੀ ਜਾਨ ਖਤਰੇ ਤੋਂ ਬਚਾ ਸਕਦੇ ਹੋ ਕਿਉਂਕਿ ਅਸੀਂ ਘਰੇਲੂ ਉਪਚਾਰਾਂ ਦੀ ਹੀ ਵਰਤੋਂ ਕਰਕੇ ਆਪਣੀ ਜ਼ਿੰਦਗੀ ਨੂੰ ਸਫਲ ਬਣਾ ਸਕਦੇ ਹਾਂ ਜਾਂ ਕੁਦਰਤੀ ਨੁਕਸੇ ਆਪਾਂ ਵਰਤ ਕੇ ਸਵਸਥ ਰਹਿ ਸਕਦੇ ਹਾਂ ਸਿਹਤਮੰਦ ਰਹਿ ਸਕਦੇ ਹਾਂ ਇਸ ਨਾਲ ਤੁਸੀਂ ਸਿਹਤਮੰਦ ਰਹਿ ਵੀ ਸਕਦੇ ਹੋ